ਬਿਲਕੁਲ ਜੀ ਬੁਣਾਈ ਅਤੇ ਸਿਲਾਈ ਨੇ ਮੇਰੇ ਜੀਵਨ ਦੇ ਉੱਤੇ ਬਹੁਤ ਪ੍ਰਭਾਵਿਤ ਕੀਤਾ ਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹੈ ਨਾ ਕਿ ਆ ਵੀ ਆਪਾਂ ਨੂੰ ਖ ਹਰੇਕ ਬੰਦੇ ਨੂੰ ਕੀ ਆ ਆਪਣੀ ਜਿਹੜੀ ਆਪਾਂ ਨੂੰ ਕੀ ਆ ਆਪਣਾ ਖਰਚਾ ਕੱਢਣ ਜੋਗੇ ਪੈਸੇ ਹੋਣੇ ਚਾਹੀਦੇ ਆ ਨਾ ਅਤੇ ਔਰਤਾਂ ਕੋਲ ਵ ਇੱਕ ਵਧੀਆ ਇਹ ਸਾਧਨ ਹੈਗਾ ਨਾ ਜਿਨ੍ਹਾਂ ਨੂੰ ਇਹ ਸਿਲਾਈ ਬ ਬੁਣਾਈ ਆਉਂਦੀ ਹੈਗੀ ਜਿਵੇਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਜਿਵੇਂ ਹੁਣ ਜੇ ਮੈਂ ਆਪਣੀ ਗੱਲ ਕਰਾਂ ਹੈ ਨਾ ਜਿਵੇਂ ਕੱਪੜਾ ਮੈਂ ਉੰਨੇ ਦਾ ਨਹੀਂ ਖਰੀਦ ਕੇ ਲਿਆਉਂਦੀ ਜਿੰਨੇ ਦੀ ਮਤਲਬ ਦੇਖਿਆ ਜਾਵੇ ਟੈਮ ਦੇ ਹਿਸਾਬ ਨਾਲ ਭੀ ਆਪਾਂ ਨੂੰ ਜਿਹੜੀ ਸਿਲਾਈ ਪੈਂਦੀ ਹੈਗੀ ਅਤੇ ਮਤਲਬ ਮੈਂ ਕੀ ਹਾਂ ਅੱਜ ਦਾ ਆਪਣੇ ਸੂਟ ਬਣਾਉਂਦੀ ਹਾਂ ਆਪ ਹੀ ਬਣਾਉਂਦੀ ਹੈਗੀ ਨਹੀਂ ਤਾਂ ਸਿਲਾਈ ਮਹਿੰਗੀ ਉੰਨਾ ਕੱਪੜਾ ਨਹੀਂ ਹੁੰਦਾ ਜਿੰਨੇ ਦੀ ਸਿਲਾਈ ਪੈ ਜਾਂਦੀ ਹੈਗੀ ਅਤੇ ਬਾਕੀ ਆਪਣੀ ਮਰਜ਼ੀ ਨਾਲ ਆਪਾਂ ਕਿਵੇਂ ਮਰਜ਼ੀ ਦਾ ਬਣਾਈਏ ਹੈ ਨਾ ਬਾਕੀ ਜੇ ਆਪਾਂ ਟੇਲਰ ਕੋਲ ਲੈ ਜਾਂਦੇ ਹਾਂ ਉਹਨਾਂ ਕੋਲ ਸਮਾਂ ਘੱਟ ਹੁੰਦਾ ਕਈ ਵਾਰ ਮੌਕੇ 'ਤੇ ਆਪਾਂ ਨੂੰ ਨਹੀਂ ਮਿਲਦਾ ਹੈ ਨਾ ਤਾਂ ਕੀ ਇਹਦੇ ਨਾਲ ਕੀ ਇੱਕ ਆਪਾਂ ਨੂੰ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਕਮਾਈ ਦੇ ਇਕ ਸਾਧਨ ਬਣ ਚੁੱਕਿਆ ਇਹ ਹੈ ਨਾ ਮੇਰਾ ਤਾਂ ਇਹ ਸਿਲਾਈ ਅਤੇ ਬੁਣਾਈ ਦੇ ਨਾਲ ਮੈਨੂੰ ਸਿਲਾਈ ਦੇ ਵਿੱਚ ਬਹੁਤ ਹੀ ਨਾਲੇ ਤਾਂ ਮੇਰਾ ਹੱਥ ਜਿਹੜਾ ਸਾਫ਼ ਹੋ ਗਿਆ ਹੈ ਨਾ ਅਤੇ ਜਿਵੇਂ ਹੁਣ ਅੱਜ ਕੱਲ੍ਹ ਦੇਖੀਏ ਹੈ ਨਾ ਜਿਨ੍ਹਾਂ ਨੂੰ ਜਿਹੜੇ ਕੁਛ ਵੀ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਨਾ ਵੀ ਕਿੰਨਾ ਲੋਕ ਜ ਜਿਵੇਂ ਤਰਪਾਈਆਂ ਕਰ ਕਰਕੇ ਵੀ ਆਪਣਾ ਘਰ ਗੁਜ਼ਾਰਾ ਕਰੀ ਜਾਂਦਾ ਨਾ ਜਿਵੇਂ ਸੂਟ ਪਿੱਛੇ ਜਿਵੇਂ ਹੁਣ ਇੱਥੇ ਤਾਂ ਤੀਹ ਰੁਪਏ ਲੈਂਦੇ ਨੇ ਹੈਨਾ ਵੀ ਸੂਟ ਦੀ ਤਰਪਾਈ ਕਰਨ ਦੇ ਅਤੇ ਮਤਲਬ ਕਿ ਬਹੁਤ ਹੀ ਮਤਲਬ ਫ਼ਾਇਦਾ ਹੋਇਆ ਗਾ ਜਿਵੇਂ ਮੈਂ ਇਹ ਗੱਲ ਕਰਾਂ ਜਿਵੇਂ ਕਿਸੇ ਦੀ ਸੂਟ ਵੀ ਸਿਊਂਗੀ ਤਾਂ ਉਹ ਸਾਢੇ ਤਿੰਨ ਸੌ ਸਿੰਪਲ ਦਾ ਰੇਟ ਹੈਗਾ ਸੂਟ ਦਾ ਜੇ ਆਪਾਂ ਡਿਜ਼ਾਈਨ ਵਾਲਾ ਬਣਾਉਂਦੇ ਹਾਂ ਤਾਂ ਉਹ ਤਾਂ ਅਲੱਗ ਅਲੱਗ ਰੇਟ ਨੇ ਜੇ ਆਪਾਂ ਲੈਸ ਲਗਾਉਂਦੇ ਤਾਂ ਪੰਜਾਹ ਸੌ ਰੁਪਇਆ ਐਵੇਂ ਅੱਗੇ ਵੱਧਦੇ ਜਾਂਦੇ ਨੇ ਅਤੇ ਬਾਕੀ ਥਰੈਡ ਨਾਲ ਕਰਕੇ ਨਾ ਸਰੀਰਕ ਦਰਦ ਤਾਂ ਦੇਖੋ ਥੋੜ੍ਹਾ ਬਹੁਤ ਤਾਂ ਹੁੰਦਾ ਹੀ ਹੈ ਜੇ ਆਪਾਂ ਬੈਠੇ ਰਹਿੰਦੇ ਆਂਗੇ ਤਾਂ ਕੀ ਆ ਥੋੜ੍ਹੀ ਜਿਹੀ ਢੂਹੀ ਦੇ ਵਿੱਚ ਦਰਦ ਹੁੰਦਾ ਗਾ ਜੇ ਆਪਾਂ ਲਗਾਤਾਰ ਬੈਠੇ ਰਹਿੰਦੇ ਹਾਂ ਜੇ ਆਪਣਾ ਬੈਠਣ ਦਾ ਤਰੀਕਾ ਸਹੀ ਹੈ ਤਾਂ ਫਿਰ ਦਿੱਕਤ ਨਹੀਂ ਆਉਂਦੀ ਹੈਗੀ ਬਾਕੀ ਸਰਕਾਰ ਨੇ ਵੀ ਬਹੁਤ ਸਾਰੇ ਉਪਰਾਲੇ ਕੀਤੇ ਹੋਏ ਨੇ ਇਸ ਪੱਖ ਨੂੰ ਲੈ ਕੇ ਤਾਂ ਉਹਨਾਂ ਨੇ ਮਤਲਬ ਕਿ ਜਿਵੇਂ ਜਿਹੜੇ ਜਿਨ੍ਹਾਂ ਦੀ ਆਮਦਨ ਦਾ ਸਰੋਤ ਬਹੁਤ ਘੱਟ ਹੈਗਾ ਉਹਨਾਂ ਨੂੰ ਮਤਲਬ ਕਿ ਫਰੀ ਜਿਹੜੀਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਮਸ਼ੀਨਾਂ ਅਤੇ ਮੈਨੂੰ ਤਾਂ ਇਸਦਾ ਬਹੁਤ ਫ਼ਾਇਦਾ ਹੋਇਆ ਗਾ ਮੈਂ ਆਪ ਸ ਕਰਦੀ ਹੈਗੀ ਆ ਨਾ ਬਣਾਉਂਦੀ ਹੈਗੀ ਸੂਟ ਅਤੇ ਮੇਰੇ ਪਰਿਵਾਰਿਕ ਮੈਂਬਰ ਵੀ ਮੇਰੇ ਤੋਂ ਹੀ ਬਣਵਾਉਂਦੇ ਨੇ ਮਤਲਬ ਕਿ ਉਹਨਾਂ ਨੂੰ ਟੇਲਰ ਤੋਂ ਪਸੰਦ ਨਹੀਂ ਆਉਂਦੇ ਗੇ ਮੈਂ ਆਪ ਹੀ ਬਣਾ ਕੇ ਦਿੰਦੀ ਹੈਗੀ ਅਤੇ ਮੈਨੂੰ ਮਤਲਬ ਕਿ ਖੁਸ਼ੀ ਹੁੰਦੀ ਹੈ ਬਣਾ ਕੇ ਬਾਕੀ ਮੈਂ ਜੇ ਮੈਂ ਮਤਲਬ ਇਕ ਤਰ੍ਹਾਂ ਦੇ ਕਮਾਈ ਦਾ ਵੀ ਕਰ ਜੇ ਮੈਂ ਚਾਹਵਾਂ ਤਾਂ ਮੈਂ ਮਤਲਬ ਮੈਂ ਹੋਰ ਲੋਕਾਂ ਦੇ ਵੀ ਬਣਾ ਕੇ ਇੱਕ ਕਮਾਈ ਦੇ ਸਾਧਨ ਪੱਖੋਂ ਇਹਨੂੰ ਵਰਤ ਸਕਦੀ ਹੈਗੀ